ਹਾਲ ਹੀ ਕੁਝ ਸਮੇਂ ਪਹਿਲੇ ਮੈਂ ਅਤੇ ਮੇਰੇ ਦੋਸਤਾਂ ਨੇ ਯਾਤਰਾ ਕੀਤੀ ਸੀ ਜਿੱਥੇ ਅਸੀਂ ਅਲੱਗ ਅਲੱਗ ਸਥਾਨਾਂ ਦੀ ਤਸਵੀਰਾਂ ਖਿੱਚੀਆਂ ਸੀ ਜਿਵੇਂ ਕਿ ਅਸੀਂ ਹਾਲ ਫਿਲਹਾਲ ਹੀ ਕੇਦਾਰਨਾਥ ਗਏ ਸੀ ਜਿੱਥੇ ਅਸੀਂ ਮੰਦਰ ਦੀ ਜਾਨਵਰਾਂ ਦੀ ਜਿਵੇਂ ਕਿ ਬਾਂਦਰ ਉੱਥੇ ਦੇ ਅਲੱਗ ਅਲੱਗ ਖਾਣੇ ਦੀ ਜਗ੍ਹਾਵਾਂ ਦੀ ਅਸੀਂ ਫੋਟੋਆਂ ਕਲਿੱਕ ਕੀਤੀਆਂ ਸੀ ਤਸਵੀਰਾਂ ਖਿੱਚੀਆਂ ਸੀ ਜੋ ਕਿ ਬਹੁਤ ਹੀ ਅੱਛੀ ਆਈ ਸੀ ਅਤੇ ਮੈਂ ਅਜੇ ਸਥਾਨਾਂ 'ਤੇ ਸਫਰ ਕਰਨ ਤੋਂ ਬਾਅਦ ਯਾਤਰਾ ਕਰਨ ਤੋਂ ਬਾਅਦ ਹੁਣ ਮੇਰਾ ਮਨ ਹੈ ਕਿ ਮੈਂ ਹੋਰ ਵੀ ਜਗ੍ਹਾਵਾਂ 'ਤੇ ਜਾਵਾਂ ਅਤੇ ਹੋਰ ਤਸਵੀਰਾਂ ਖਿੱਚਾਂ ਅਤੇ ਹੁਣ ਮੇਰਾ ਮਨ ਕਰਦਾ ਹੈ ਕਿ ਮੈਂ ਦਿੱਲੀ ਜਾਵਾਂ ਆਗਰਾ ਜਾਵਾਂ ਅੰਮ੍ਰਿਤਸਰ ਜਾਵਾਂ ਇ ਇਹੋ ਜਿਹੇ ਹੀ ਅਲੱਗ ਅਲੱਗ ਸਥਾਨਾਂ 'ਤੇ ਜਾ ਕੇ ਮੈਂ ਤਸਵੀਰਾਂ ਖਿੱਚਾਂ ਅਤੇ ਇਸ ਨਾਲ ਮੇਰੀ ਉਹ ਜ਼ਿਆਦਾ ਯਾਦਾਵਾਂ ਕੈਮਰੇ ਦੇ ਅੰਦਰ ਕੈਦ ਹੋ ਜਾਣਗੀਆਂ ਅਤੇ ਸਿਰਫ ਇਹੀ ਨਹੀਂ ਇਸ ਦੇ ਨਾਲ ਸਾਨੂੰ ਹੋਰ ਬਹੁਤ ਹੀ ਐਕਸਪੀਰੀਅੰਸ ਮਿਲਦਾ ਹੈ ਬਹੁਤ ਹੀ ਜ਼ਿਆਦਾ ਸਾਨੂੰ ਗਿਆਨ ਮਿਲਦਾ ਹੈ ਅਲੱਗ ਅਲੱਗ ਸਥਾਨ ਦਾ ਅਤੇ ਸਾਡੇ ਭਾਰਤ ਦੇਸ਼ ਦਾ ਇਸ ਲਈ ਮੈਂ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਜ਼ਿਆਦਾ ਯਾਤਰਾ ਕਰਾਂਗਾ ਅਤੇ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰਾਂਗਾ